ਲਾਈਵ ਮਾਡਲ ਸਥਿਰ ਜੀਵਨ ਸੈੱਟਅੱਪ ਇਸ ਤਰ੍ਹਾਂ ਹੈ ਨਹੀਂ ਜਾਂ ਮੈਂ ਆਪਣੀ ਜ਼ਿੰਦਗੀ 'ਚ ਕਦੇ ਵੀ ਲਾਈਵ ਮਾਡਲ ਜੀਵਨ ਸਥਿਰ ਸਟੈਪ ਦੇਖ ਕੇ ਚਿੱਤਰ ਨਹੀਂ ਬਣਾਇਆ ਪਰ ਮੈਂ ਤੁਹਾਨੂੰ ਉਸ 'ਤੇ ਅਨੁਭਵ ਅਤੇ ਮੁਸ਼ਕਿਲਾਂ ਬਾਰੇ ਦੱਸਣਾ ਚਾਹੁੰਦਾ ਹਾਂ ਲਾਈਵ ਮਾਡਲ ਅਤੇ ਸਥਿਰ ਜੀਵਨ ਸਟੈਪ ਤੋਂ ਦੇਖ ਕੇ ਚਿੱਤਰ ਬਣਾਉਣ ਦਾ ਅਨੁਭਵ ਕਾਫੀ ਨਿਰਾਲਾ ਅਤੇ ਚੁਣੌਤੀਆਂ ਭਰਿਆ ਹੁੰਦਾ ਹੈ ਲਾਈਵ ਮਾਡਲ ਜਾਂ ਸਥੀਰ ਜੀਵਨ ਨੂੰ ਸਟੈਪ ਨੂੰ ਧਿਆਨ ਨਾਲ ਵੇਖਣਾ ਪੈਂਦਾ ਹੈ ਅਤੇ ਛੋਟੇ ਛੋਟੇ ਵੇਰਵਿਆਂ ਨੂੰ ਕੈਦ ਕਰਨ ਲਈ ਬਹੁਤ ਠਹਿਰਾਅ ਦੀ ਲੋੜ ਹੁੰਦੀ ਹੈ ਸੰਯਮ ਦੀ ਲੋੜ ਹੁੰਦੀ ਰਹੀ ਆਸੇ ਧੰਨਵਾਦ ਜੀ